ਹੈਲੋ ਹਾਂਜੀ ਸਰਵੋਤਮ ਅਕੈਡਮੀ ਚੀਮਾ ਜੋਧਪੁਰ ਤੋਂ ਜੀ ਸਰਵੋਤਮ ਅਕੈਡਮੀ ਚੀਮਾ ਜੋਧਪੁਰ ਤੋਂ ਬੋਲ ਰਹੇ ਸਰ ਮੈਂ ਸਰ ਇੱਥੋਂ ਤੂੰ ਬੋਲ ਰਿਹਾ ਸੀਗਾ ਪੁਡੀ ਕਲਾ ਤੋਂ ਪਰਵਿੰਦਰ ਸਿੰਘ ਹਾਂਜੀ ਇੱਕ ਸਰ ਐਡ ਪੜੀ ਸੀ ਤੁਹਾਡੇ ਆਪਣੇ ਸਕੂਲ ਦੀ ਸੰਸਥਾ ਦੀ ਇਹਦੇ ਵਿੱਚ ਸਰ ਆਪਣਾ ਨਿਊਜ਼ ਪੇਪਰ ਦੇ ਵਿੱਚ ਤੁਸੀਂ ਐਡ ਕਰਵਾਈ ਬਈ ਟੀਚਰ ਦੀ ਲੋੜ ਹੈ ਸਮਾਜਿਕ ਸਿੱਖਿਆ ਹਾਂਜੀ ਹਾਂਜੀ ਸੇਮ ਸੇਮ ਉਹਦੇ ਰਿਗਾਰਡਿੰਗ ਸਰ ਮੈਂ ਆਪਣੇ ਆਪ ਨੂੰ ਆਫਰ ਕਰ ਰਿਹਾ ਜੀ ਜੋਬ ਦੇ ਲਈ ਅਤੇ ਬਈ ਹਾਂਜੀ ਐਜ਼ ਪਰ ਰਿਕਵਾਇਰਮੈਂਟ ਮੈਂ ਆਪਣੇ ਆਪ ਨੂੰ ਆਫਰ ਕਰ ਰਿਹਾ ਬਈ ਤੁਹਾਡੇ ਸੰਸਥਾ ਦੇ ਵਿੱਚ ਕੰਮ ਕਰਨਾ ਚਾਹੁੰਦਾ ਮੈਂ ਹਾਂਜੀ ਕੁਆਲੀਫਿਕੇਸ਼ਨ ਸਰ ਮੇਰੀ ਐੱਮ ਏ ਬੀ ਐਡ ਹੈ ਐਮ ਏ ਪਲੀਟੀਕਲ ਸਾਇੰਸ ਨਾਲ ਬੀ ਐੱਡ ਕੀਤੀ ਹੈ ਸਰ ਮੈ ਸੁਧਾਰ ਕਾਲਜ ਤੋਂ ਜੀ ਬੀ ਐੱਡ ਕੌਲਜ ਸੁਧਾਰ ਬੀ ਐਡ ਕੋਮਬੀਨੈਸ਼ਨ ਸਰ ਮੇਰਾ ਐਸ ਐਸ ਪੰਜਾਬੀ ਹੈ ਸੋਸਲ ਸਟੇਡੀ ਐਟ ਪੰਜਾਬੀ ਐਂਡ ਪੋਸਟ ਗਰੈਜੂਏਸ਼ਨ ਦੇ ਵਿੱਚ ਹੈ ਜੀ ਮੇਰੀ ਫਸਟ ਡਿਵੀਜ਼ਨ ਹੈ ਸਿਕਸਟੀ ਫ਼ੈਈਵ ਪਰਸੈਂਟ ਮਾਰਕਸ ਫਰੌਮ ਪੰਜਾਬੀ ਯੂਨੀਵਰਸਿਟੀ ਪਟਿਆਲਾ

ਇਹ ਸਰ ਆਪਣਾ ਪੰਜਾਬ ਯੂਨੀਵਰਸਿਟੀ ਚੰਡੀਗੜ ਹਾਂਜੀ ਹੂੰ

ਬਿਲਕੁਲ ਸਰ ਬਿਲਕੁਲ ਜੀ ਪੜ੍ਹਾਈ ਬੇਸ ਇਸ ਤੋਂ ਪਹਿਲਾਂ ਸਰ ਮੇਰੇ ਕੋਲ ਦੋ ਸਾਲ ਦਾ ਤਜਰਬਾ ਵੀ ਹੈ ਉਹ ਸਰ ਸ਼ਾਂਤੀ ਨਿਕੇਤਨ ਹੈ ਜੀ ਕਾਲੀ ਕੇ ਉੱਥੋਂ ਦਾ ਤਜਰਬਾ ਜੀ ਮੇਰੇ ਕੋਲ ਦੋ ਸਾਲ ਦਾ ਉੱਥੇ ਸਰ ਮੈਂ ਸੋਸ਼ਲ ਸਟਡੀ ਅਤੇ ਪੋਲੀਟੀਕਲ ਸਾਇੰਸ ਕਰਾਉਂਦਾ ਸੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਹਾਂਜੀ ਹਾਂਜੀ ਬਿਲਕੁਲ

ਹਾਂਜੀ ਬਿਲਕੁਲ ਠੀਕ ਠੀਕ ਸਰ ਹਾਂਜੀ ਠੀਕ ਹੈ ਜੀ ਬਿਲਕੁਲ ਸਰ ਬਿਲਕੁਲ ਜੀ ਕਿਉਂਕਿ ਮੈਂ ਸਮਾਜਿਕ ਸਿੱਖਿਆ ਵੀ ਦਸਵੀਂ ਤੱਕ ਪੜ੍ਹਾਈ ਸਰ ਉੱਥੇ ਪੋਲੀਟੀਕਲ ਸਾਇੰਸ ਦੇ ਨਾਲ ਜੋ ਮੇਰੀ ਟੈਂਥ ਕਲਾਸ ਵਿਸ਼ਾ ਸੀ ਸਮਾਜਿਕ ਸਿੱਖਿਆ ਅੱਪ ਟੂ ਟੈਂਥ ਸੀ ਜੀ ਮੇਰਾ ਇਸ ਦੇ ਨਾਲ ਕਦੇ ਕਦੇ ਮੈਨੂੰ ਪੰਜਾਬੀ ਜਿਹੜੀ ਅਜਸਟਮੈਂਟ ਵੀ ਮਿਲੀ ਜਾਂਦੀ ਸੀ ਅਤੇ ਨਾਲ ਹੀ ਕਰਵਾਉਂਦਾ ਸੀ ਹਾਂਜੀ ਹਾਂਜੀ ਅਕਸੈਪਟ ਸਰ ਮੈਂ ਪਹਿਲਾਂ ਦਸ ਟੈਨ ਥਾਉਸੈਂਡ ਲੈ ਰਿਹਾ ਸੀ ਦਸ ਹਜ਼ਾਰ ਅਤੇ ਹੁਣ ਜੋ ਹਾਂਜੀ ਹੁਣ ਜੋ ਮੇਰੀ ਹੈ ਸਰ ਐਕਸਪੈਕਟੇਸ਼ਨ ਉਹ ਹੈ ਤਕਰੀਬਨ ਚੌਦਾਂ ਹਜ਼ਾਰ ਰੁਪਏ ਜੀ

ਬਿਲਕੁਲ ਬਿਲਕੁਲ ਠੀ ਠੀਕ ਹੈ ਸਰ

ਠੀਕ ਹੈ ਸਰ ਜ਼ਰੂਰ ਜੀ ਆਉਣ ਵਾਲੇ ਸੋਮਵਾਰ ਨੂੰ ਆਪਾਂ ਮਿਲ ਲੈਂਦੇ ਹਾਂ ਸਰ

ਠੀਕ ਸਰ ਠੀਕ ਠੀਕ ਠੀਕ ਠੀਕ ਸਰ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਓਕੇ ਸਰ ਓਕੇ ਸਰ